ਔਨਲਾਈਨ ਸ਼ੋਪਿੰਗ ਕਰਨਾ ਮੈਨੂੰ ਬਹੁਤ ਪਸੰਦ ਹੈ ਅੱਜ ਕੱਲ੍ਹ ਦੇ ਸਮੇਂ ਨਾਲ ਮੈਂ ਔਨਲਾਈਨ ਸ਼ੋਪਿੰਗ ਜਾ ਕਰਨਾ ਜ਼ਿਆਦਾ ਪਸੰਦ ਕਰਦਾ ਇੱਕ ਇਹਦੇ ਵਿੱਚ ਕੀ ਹੈ ਕਿ ਟਾਈਮ ਵੀ ਬੱਚਤ ਹੁੰਦੀ ਹੈ ਅਤੇ ਤੁਹਾਨੂੰ ਘਰ ਬੈਠਿਆਂ ਹੀ ਚੀਜ਼ ਮਿਲ ਜਾਂਦੀ ਹੈ ਅੱਜ ਕੱਲ੍ਹ ਤਾਂ ਵੱਖ ਵੱਖ ਪਲੇਟਫਾਰਮ ਬਣੇ ਹੋਏ ਹਨ ਔਨਲਾਈਨ ਦੇ ਵੈੱਬਸਾਈਟ ਅਸੀਂ ਔਡਰ ਕਰਦੇ ਹਾਂ ਸਾਡੇ ਤੱਕ ਪਹੁੰਚ ਜਾਂਦਾ ਹੈ ਇੱਕ ਕੈਸ਼ਲੈਸ ਹੈ ਅੱਗੇ ਮਾਰਕੀਟ ਜਾਣਾ ਕੈਸ਼ ਕੱਢਣਾ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਸੀ ਪਰ ਹੁਣ ਬਦਲਦੇ ਸਮੇਂ ਨਾਲ ਔਨਲਾਈਨ ਸ਼ੋਪਿੰਗ ਸਭ ਤੋਂ ਬੈਸਟ ਹੈ ਪਰ ਕਈ ਵਾਰੀ ਔਨਲਾਈਨ ਦਾ ਨੁਕਸਾਨ ਵੀ ਹੋ ਜਾਂਦਾ ਉਹਦਾ ਕਾਰਨ ਇਹ ਚੀਜ਼ ਦਾ ਔਡਰ ਕੁਛ ਦਿਖਦਾ ਹੈ ਪਰ ਮਿਲਦਾ ਕੁਛ ਕਈ ਵਾਰੀ ਦੇਰ ਨਾਲ ਆਉਂਦਾ ਹੈ ਤਾਂ ਥੋੜ੍ਹੀ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਪਰ ਇਹਦਾ ਬਾਜ਼ਾਰ 'ਤੇ ਵੀ ਕਾਫ਼ੀ ਅਸਰ ਪਿਆ ਹੈ ਕਿਉਂਕਿ ਦੁਕਾਨਦਾਰਾਂ ਨੇ ਅੱਗੇ ਕੀ ਹੁੰਦਾ ਰਸ਼ ਹੁੰਦਾ ਸੀ ਦੁਕਾਨਾਂ 'ਤੇ ਗਾਹਕ ਬਹੁਤ ਹੁੰਦਾ ਸੀ ਔਨਲਾਈਨ ਸ਼ੋਪਿੰਗ ਹੋਣ ਨਾਲ ਉਹ ਚੀਜ਼ਾਂ ਘੱਟਦੀਆਂ ਜਾ ਰਹੀਆਂ ਨੇ ਕਿਉਂਕਿ ਹਰ ਇੱਕ ਬਦਲਦੇ ਸਮੇਂ ਨਾਲ ਬਦਲਣਾ ਚਾਹੁੰਦਾ ਹੈ ਕਿਉਂਕਿ ਉਹਨੂੰ ਹੁੰਦਾ ਕਿ ਘੱਟ ਸਮਾਂ ਲੱਗੇ ਚੀਜ਼ ਮੇਰੇ ਤੱਕ ਪਹੁੰਚ ਜਾਵੇ ਮੈਂ ਆਪਣੇ ਹੋਰ ਕੰਮ ਕਰ ਸਕਾਂ